ਆਧੁਨਿਕ ਯੁੱਗ ਵਿੱਚ ਜਿੱਥੇ ਵਿਗਿਆਨ ਨੇ ਤਰੱਕੀ ਕਰ ਕੇ ਹਰੇਕ ਸਥਾਨ ਵਿੱਚ ਸੌਖਤਾ ਦੇ ਦਿੱਤੀ ਹੈ ਉੱਥੇ ਹੀ ਅੱਜ ਦੇ ਸਮੇਂ ਵਿੱਚ ਸਭ ਤੋਂ ਵੱਡੀ ਸੌਖਤਾ ਘਰ ਬੈਠੇ ਓਨਲਾਈਨ ਕਿਸੇ ਵੀ ਸਟੋਰ ਤੋਂ ਕੁਝ ਵੀ ਮੰਗਾਉਣ ਵਾਲੀ ਸੌਖਤਾ ਸਭ ਨੂੰ ਪ੍ਰਦਾਨ ਕੀਤੀ ਹੈ ਮੈਂ ਵੀ ਇਸੇ ਤਰ੍ਹਾਂ ਓਨਲਾਈਨ ਸਟੋਰ ਤੋਂ ਕੁਝ ਉੱਚ ਗੁਣਵਤਾ ਵਾਲਿਆਂ ਕੱਪੜਿਆਂ ਦੀ ਖਰੀਦ ਕੀਤੀ ਜਿਸ 'ਤੇ ਮੈਂ ਆਪਣਾ ਇੱਕ ਫੀਡਬੈਕ ਛੱਡ ਰਹੀ ਹਾਂ ਪਹਿਲਾਂ ਕੁਝ ਕੁ ਓਨਲਾਈਨ ਸਟੋਰ ਸਾਨੂੰ ਕੁਝ ਹੋਰ ਮਟੀਰੀਅਲ ਦਿਖਾਉਂਦੇ ਅਤੇ ਐਕਸਪਲੇਨ ਕਰਦੇ ਨੇ ਪਰ ਜਦੋਂ ਉਹ ਚੀਜ਼ ਸਾਡੇ ਤੱਕ ਪਹੁੰਚਦੀ ਹੈ ਤਾਂ ਉਹ ਹੋਰ ਵੱਖਰੇ ਹੀ ਰੂਪ ਵਿੱਚ ਮਿਲਦੀ ਹੈ ਅਤੇ ਕੁਝ ਓਨਲਾਈਨ ਸਟੋਰ ਬਹੁਤ ਹੀ ਵਧੀਆ ਸਰਵਿਸ ਪ੍ਰੋਵਾਈਡ ਕਰਦੇ ਹਨ ਮੈਂ ਜਿਸ ਆਨਲਾਈਨ ਸਟੋਰ ਤੋਂ ਕੱਪੜਿਆਂ ਦੀ ਖਰੀਦ ਕੀਤੀ ਉਸ ਤੋਂ ਵਿੱਚ ਜੋ ਮੈਨੂੰ ਮਟੀਰੀਅਲ ਮਿਲਿਆ ਉਹ ਬਹੁਤ ਹੀ ਵਧੀਆ ਕਿਸਮ ਦਾ ਹੈ ਅਤੇ ਮੈਂ ਇਹ ਕਹਿਣਾ ਚਾਹੂੰਗੀ ਓਨਲਾਈਨ ਸਟੋਰ ਮਾਲਕਾਂ ਨੂੰ ਕਿ ਕਿਰਪਾ ਜੋ ਸਮਾਨ ਦੀ ਸੂਚੀ ਤੁਸੀਂ ਓਨਲਾਈਨ ਸਟੋਰ ਦੇ ਕੈਪਸ਼ਨ ਵਿੱਚ ਦਿੱਤੀ ਹੁੰਦੀ ਹੈ ਗਾਹਕ ਨੂੰ ਉਹੀ ਪ੍ਰਦਾਨ ਕਰਿਆ ਕਰੋ ਤਾਂ ਜੋ ਲੋਕ ਓਨਲਾਈਨ ਸਟੋਰਾਂ ਤੋਂ ਖਰੀਦ ਕਰਨ ਵਿੱਚ ਖੱਜਲ ਖੁਆਰ ਨਾ ਹੋਣ ਧੰਨਵਾਦ